ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਮੈਮ ਤੁਸੀਂ ਵਿਜਿਟ ਕਰ ਲਿਓ ਆਪਾਂ ਇੱਕ ਸਕੀਮਸ ਕਰ ਦਾਂਗੇ ਤੁਹਾਡਾ ਮੋਬਾਇਲ ਅਤੇ ਤੁਹਾਡੀ ਕਪਲੇਂਟ ਪਾ ਦਾਂਗੇ ਮੈਮ ਤੁਸੀਂ ਸਾਡੇ ਕੋਲ ਆ ਕੇ ਰਿਟਰਨ ਕਰ ਦਿਓ ਇੱਕ ਦੋ ਦਿਨ ਦਾ ਪਰੋਸੈਸ ਹੋਏਗਾ ਰਿਟਰਨ ਮੰਗਵਾ ਆਪਾਂ ਬਾਏ ਕਰ ਕੇ ਦੇ ਦਾਂਗੇ ਨਵਾਂ ਦੇਵਾਂਗੇ ਮੈਮ ਅਗਰ ਉਹ ਠੀਕ ਫਿਰ ਠੀਕ ਹੋਣ ਲਈ ਦੇਵਾਂਗੇ ਅਤੇ ਉਹ ਠੀਕ ਹੋ ਕੇ ਆਏਗਾ ਅਤੇ ਉਹ ਆਪਾਂ ਕਿਸੇ ਹੋਰ ਕਸਟਮਰ ਨੂੰ ਪੇ ਕਰ ਦਾਂਗੇ ਤੁਹਾਨੂੰ ਆਪਾਂ ਨਵਾਂ ਪ੍ਰੋਡਕਟ ਦੇ ਦਾਂਗੇ ਨਹੀਂ ਮੈਮ ਤੁਹਾਨੂੰ ਅੱਗੇ ਤੋਂ ਵਧੀਆ ਕੁਆਲਟੀ ਦੀ ਚੀਜ਼ ਹੀ ਦੇਵਾਂਗੇ ਉਹ ਕੋਈ ਉਹਦੀ ਆਪਣੀ ਐਰਰ ਕਰਕੇ ਪ੍ਰੋਬਲਮ ਆਂਦੀ ਹੋਏਗੀ ਆਪਾਂ ਚੈਕ ਕਰਵਾ ਕੇ ਠੀਕ ਕਰਵਾ ਦਾਂਗੇ ਤੁਹਾਨੂੰ ਅਗਲਾ ਪ੍ਰੋਡਕਟ ਵਧੀਆ ਦੇਵਾਂਗੇ ਓਕੇ ਮੈਮ